ਹੈਲੋ ਸਤਿ ਸ਼੍ਰੀ ਅਕਾਲ ਸਰ ਸਰ ਜੀ ਚਾਵਲਾ ਤੋਂ ਬੋਲਦੇ ਪਏ ਹੋ ਤੁਸੀਂ ਸੁਜਾਨਪੁਰ ਤੋਂ ਹਾਂਜੀ ਹਾਂਜੀ ਸਰ ਸਰ ਮੈਂ ਨਾ ਪਰਸੋਂ ਔਡਰ ਪਲੇਸ ਕੀਤਾ ਸੀਗਾ ਇੱਕ ਮੇਰੇ ਭਰਾ ਦੀ ਬਰਡੇ ਪਾਰਟੀ ਸੀਗੀ ਕੱਲ੍ਹ ਅਤੇ ਮੈਂ ਔਡਰ ਪਲੇਸ ਕੀਤਾ ਸੀਗਾ ਇੱਕ ਤਿੰਨ ਪੀਜਾ ਸੀਗੇ ਅਤੇ ਮਤਲਬ ਵੀਹ ਵੀਹ ਸਮੋਸੇ ਸੀਗੇ ਅਤੇ ਔਡਰ ਨੰਬਰ ਵੀ ਸ਼ਾਇਦ ਏਟ ਨਾਈਨ ਸਿਕਸ ਥ੍ਰੀ ਫੋਰ ਟੂ ਸੀਗਾ ਹਾਂਜੀ ਵੰਸ਼ ਨਾਮ ਹੈ ਮੇਰਾ ਅਤੇ ਮੈਂ ਔਡਰ ਪਲੇਸ ਕੀਤਾ ਸੀਗਾ ਪਰਸੋਂ ਕੀਤਾ ਸੀਗਾ ਕੱਲ੍ਹ ਲਈ ਹਾਂਜੀ ਅਤੇ ਸਰ ਕਿਸੇ ਐਮਰਜੇਂਸੀ ਕਰਕੇ ਨਾ ਮੈਨੂੰ ਔਡਰ ਮਤਲਬ ਕੈਂਸਲ ਕਰਨਾ ਪੈ ਗਿਆ ਸੀਗਾ ਅਤੇ ਮੈਂ ਮਤਲਬ ਪੇਮੈਂਟ ਜਿਹੜੀ ਸੀਗੀ ਔਨਲਾਈਨ ਹੀ ਕਰ ਦਿੱਤੀ ਸੀਗੀ ਗੂਗਲ ਪੇ ਦੇ ਥਰੂ ਹਾਂਜੀ ਹਾਂਜੀ ਅਤੇ ਸਰ ਮਤਲਬ ਮੈਨੂੰ ਨਾ ਹਜੇ ਤੱਕ ਉਸ ਚੀਜ਼ ਦਾ ਰਿਫੰਡ ਨਹੀਂ ਆਇਆ ਵਾਪਸ ਹਾਂਜੀ ਅਤੇ ਮਤਲਬ ਜਿੱਦਾਂ ਮੈਂ ਮਤਲਬ ਅਗਰ ਕਰਦਾ ਮਤਲਬ ਜਲਦੀ ਕਰ ਦਿੰਦਾ ਤਾਂ ਠੀਕ ਸੀਗਾ ਲੇਕਿਨ ਮੈਂ ਮਤਲਬ ਔਡਰ ਚੌਵੀ ਘੰਟਿਆਂ ਤੋਂ ਪਹਿਲਾਂ ਪਹਿਲਾਂ ਹੀ ਕਰ ਦਿੱਤਾ ਸੀਗਾ ਕੈਂਸਲ ਅਤੇ ਮੈਨੂੰ ਰਿਫੰਡ ਨਹੀਂ ਆਇਆ ਨਾ ਹੀ ਓਹਦੇ ਮਤਲਬ ਓਹਦੇ ਲਈ ਕੋਈ ਨੋਟੀਫਿਕੇਸ਼ਨ ਵਗੈਰਾ ਆਈ ਹੈ ਜਾਂ ਕੁਛ ਹੋਰ ਕੋਈ ਅੱਪਡੇਟ ਵਗੈਰਾ ਆਇਆ ਹੈਗਾ ਅਤੇ ਸਰ ਪਲੀਸ ਮਤਲਬ ਹਾਂਜੀ ਓਕੇ ਥੈਂਕ ਊ ਸਰ ਧੰਨਵਾਦ